ਮੈਂ ਇੱਕ ਗਾਇਕ ਹਾਂ ਅਤੇ ਜਦੋਂ ਵੀ ਮੈਂ ਕੋਈ ਗਾਣਾ ਰਿਕੋਡ ਕਰਨਾ ਹੁੰਦਾ ਹੈ ਤਾਂ ਮੈਂ ਹਰ ਰੋਜ਼ ਆਪਣੇ ਘਰ ਸਵੇਰੇ ਦੋ ਘੰਟੇ ਸ਼ਾਮ ਨੂੰ ਦੋ ਘੰਟੇ ਰਿਆਜ਼ ਕਰਦਾ ਹਾਂ ਅਤੇ ਰਿਆਜ਼ ਪੂਰੀ ਤਰ੍ਹਾਂ ਕਰਨ ਤੋਂ ਬਾਅਦ ਜਦੋਂ ਮੈਂ ਖੁਦ ਸੰਤੁਸ਼ਟ ਹੋ ਜਾਨਾ ਹਾਂ ਕਿ ਮੈਂ ਗਾਣਾ ਵਧੀਆ ਤਰੀਕੇ ਨਾਲ਼ ਗਾ ਰਿਹਾ ਹਾਂ ਤਾਂ ਮੈਂ ਫਿਰ ਕੋਈ ਵਧੀਆ ਸਟੂਡੀਓ ਦੇਖਦਾ ਹਾਂ ਕੋਈ ਵਧੀਆ ਕਲਾਕਾਰ ਦੇਖਦਾ ਜੋ ਕਿ ਇਸ ਦੀ ਰਿਕੋਡਿੰਗ ਕਰਾ ਸਕੇ ਸਟੂਡੀਓ ਵਿੱਚ ਅਤੇ ਫਿਰ ਵਧੀਆ ਉਹਦੇ ਕੋਲੋਂ ਸੰਗੀਤ ਲੈ ਕੇ ਤੇ ਫਿਰ ਮੈਂ ਵਧੀਆ ਤਰੀਕੇ ਨਾਲ਼ ਰਿਕੋਡਿੰਗ ਗਾਣੇ ਦੀ ਕਰ ਸਕਾਂ ਅਤੇ ਇਸ ਤਰੀਕੇ ਨਾਲ਼ ਮੈਂ ਰਿਕੋਡਿੰਗ ਕਰਦਾ ਹਾਂ